ਮਸ਼ਹੂਰ ਹਸਤੀਆਂ ਨੂੰ ਪ੍ਰਾਈਵੇਸੀ ਏ ਇਸ ਲਈ ਨਹੀਂ ਮਿਲ ਪਾਉਂਦੀ ਕਿਉਂਕਿ ਪਹਿਲੀ ਗੱਲ ਤਾਂ ਆਂ ਹਰ ਆਮ ਇਨਸਾਨ ਬਣਨਾ ਚਾਹੁੰਦਾ ਹੈ ਮਸ਼ਹੂਰ ਜਦੋਂ ਇਨਸਾਨ ਮਸ਼ਹੂਰ ਬਣ ਜਾਂਦਾ ਹੈ ਤਾਂ ਉਸ ਤੋਂ ਬਾਅਦ ਹਰ ਆਮ ਇਨਸਾਨ ਬਣ ਜਾਣਨਾ ਚਾਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ ਉਹ ਕੀ ਕੰਮ ਕਰ ਰਹੇ ਹਨ ਉਹ ਕਿੱਥੇ ਜਾ ਰਿਹਾ ਉਹ ਕੀ ਖਾ ਰਿਹਾ ਉਹਨੂੰ ਕੀ ਪਹਿਨ ਰਹੇ ਹਨ ਉਹਨਾਂ ਨੂੰ ਕੀ ਪਸੰਦ ਹੈ ਉਹਨਾਂ ਨੂੰ ਕਿਹੜਾ ਕਲਾਕਾਰ ਪਸੰਦ ਹੈ ਉਹ ਕਿਹੜਾ ਗਾਣਾ ਸੁਣਦੇ ਹਨ ਉਹ ਕਿਹੜੇ ਕੱਪੜੇ ਪਾਉਂਦੇ ਹਨ ਜਾਂ ਫਿਰ ਇਹੋ ਜਿਹਾ ਹੋਰ ਜਿੰਨਾ ਤੁਸੀਂ ਚਾਹੋ ਤੁਸੀਂ ਸੋਚ ਸਕਦੇ ਹੋ ਹਰ ਕੋਈ ਮਸ਼ਹੂਰ ਬਣਨਾ ਚਾਹੁੰਦਾ ਹੈ ਮਸ਼ਹੂਰ ਹੋਣ ਤੋਂ ਬਾਅਦ ਫਿਰ ਸਾਰਿਆਂ ਨੇ ਜਾਣਨਾ ਹੈ ਕਿ ਉਹ ਕੀ ਕਰਦੇ ਹਨ ਇਸ ਲਈ ਕੀ ਆ ਉਹਨਾਂ ਨੂੰ ਪ੍ਰਾਈਵੇਸੀ ਨਹੀਂ ਮਿਲ ਪਾਉਂਦੀ ਦੂਜੀ ਗੱਲ ਹੁਣ ਇਹ ਪ੍ਰਾਈਵੇਸੀ ਜਿਹੜੀ ਕੀ ਹੈ ਉਹਨਾਂ ਦੀ ਖ਼ਤਮ ਕਾਹਤੋਂ ਹੋ ਰਹੀ ਹੈ ਥਰੂ ਦਾ ਮੀਡੀਆ ਜਿਵੇਂ ਅੱਜ ਕੱਲ੍ਹ ਕਹਿੰਦੇ ਪਾਪਾਰਾਜ਼ੀ ਪਾਪਾਰਾਜ਼ੀ ਜਿਹੜੇ ਕੀ ਹੈ ਹੁਣ ਆਮ ਲੋਕ ਤਾਂ ਓਲਰੇਡੀ ਬੈਠੇ ਹੈ ਜਾਣਨ ਨੂੰ ਵੀ ਹਾਂ ਵੀ ਕੀ ਚੱਲ ਰਿਹਾ ਕਲਾਕਾਰਾਂ ਦੀ ਜ਼ਿੰਦਗੀ ਵਿੱਚ ਸਾਡਾ ਪਸੰਦੀਦਾ ਕਲਾਕਾਰ ਕੀ ਕਰ ਰਿਹਾ ਹੈ ਹੈ ਨਾ ਅਤੇ ਉੱਧਰ ਉਹੀ ਮੀਡੀਆ ਜਿਹੜੇ ਪਾਪਾਰਾਜ਼ੀ ਆ ਉਹ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚਾਉਂਦੇ ਹਨ ਚਾਹੇ ਉਹ ਆਪਦੇ ਘਰ ਜਾ ਰਹੇ ਹੋਣ ਚਾਹੇ ਉਹ ਕਿਤੇ ਕੋਫੀ ਸ਼ੋਪ 'ਤੇ ਜਾ ਰਹੇ ਹੋਣ ਚਾਹੇ ਉਹਨਾਂ ਨੇ ਮੂਵੀ ਵੇਖਣੀ ਹੋਵੇ ਚਾਹੇ ਉਹਨਾਂ ਨੇ ਕੁਛ ਖਾਣਾ ਹੋਵੇ ਚਾਹੇ ਉਹਨਾਂ ਨੇ ਰੱਬ ਦੇ ਦਰਸ਼ਨ ਭਗਵਾਨ ਦੇ ਘਰ ਹੀ ਜਾਣਾ ਕਿਉਂ ਨਾ ਜਾਣਾ ਹੋਵੇ ਤਾਂ ਵੀ ਉਹ ਕੈਮਰਾ ਲੈ ਕੇ ਉੱਥੇ ਪਹੁੰਚ ਜਾਂਦੇ ਹਨ ਫਿਰ ਇਹ ਕਿਤੇ ਨਾ ਕਿਤੇ ਇਸ ਦਾ ਜਿਹੜਾ ਆਪਾਂ ਕੀ ਹੈ ਦੋਸ਼ ਪਾਪਾਰਾਜ਼ੀ ਨੂੰ ਵੀ ਦੇ ਸਕਦੇ ਹਾਂ ਕਿਉਂਕਿ ਠੀਕ ਹੈ ਲੋਕ ਮਸ਼ਹੂਰ ਹੁੰਦੇ ਹਨ ਮਸ਼ਹੂਰ ਹਸਤੀਆਂ ਹੁੰਦੀਆਂ ਹਨ ਪਰ ਉਹਨਾਂ ਨੂੰ ਤਾਂ ਵੀ ਕਿਤੇ ਨਾ ਕਿਤੇ ਪ੍ਰਾਈਵੇਸੀ ਦੇਣ ਦਾ ਹੱਕ ਬਣਦਾ ਹੈ ਕਿਉਂਕਿ ਅਕਸਰ ਹੈ ਐਂਡ ਓਫ ਦਾ ਡੇਅ ਉਹ ਵੀ ਬੰਦੇ ਹੀ ਹਨ ਪਰ ਜਿਹੜੇ ਪਾਪਾਰਾਜ਼ੀ ਆ ਉਹ ਇਸ ਨੂੰ ਇਸ ਐਕਸਟੈਂਡ ਤੱਕ ਲੈ ਕੇ ਜਾ ਲੈ ਕੇ ਲੈ ਕੇ ਜਾਂਦੇ ਹਨ ਕਿ ਉਹ ਹਾਮ ਉਹਨਾਂ ਮਸ਼ਹੂਰ ਹਸਤੀਆਂ ਲਈ ਔਖਾ ਹੋ ਜਾਂਦਾ ਹੈ